ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਲੀ ਬੁੱਕ ਤੋਂ ਬੋਲਦੇ ਆ ਜੀ ਬਸ ਠੀਕ ਆ ਵੀਰ ਕਿਤਾਬਾਂ ਜੀ ਨੇ ਦੇਣੀ ਸੀ ਆਪਣਾ ਕਿਆ ਕਾਪੀਆਂ ਦੇ ਅੱਛਾ ਜੀ ਅਤੇ ਕਿਆ ਰੇਟ ਦੀਆਂ ਵੀਰ ਕਿਆ ਰੇਟ ਪਉਂਗੀਆਂ ਅੱਛਿਆ ਜੀ ਅੱਛਿਆ ਅੱਛਾ ਦਰਜਨ ਹੁੰਦੀ ਹੈ ਮਤਲਬ ਹੋਰ ਕੋਈ ਹੈ ਤਾਂ ਸੱਠ ਰੁਪਏ ਸੀ ਜੀ ਅੱਛਾ ਜੀ ਠੀਕ ਹੈ ਵੀਰ ਜੀ ਅਤੇ ਆਪਣੇ ਕੋਲ ਹੋਰ ਪੈੱਨ ਪੁੰਨ ਕਾਪੀਆਂ ਵਗੈਰਾ ਪੈੱਨ ਹੁੰਦਾ ਹੋਰ ਵਧੀਆ ਜਿਹੜਾ ਬ੍ਰਾਂਡ ਬ੍ਰਾਂਡ 'ਚ ਹੈਗਾ ਬ੍ਰਾਂਡ 'ਚ ਵਧੀਆ ਸੈਲੋ ਸੂਲੋ ਜਾਂ ਹੋਰ ਬ੍ਰਾਂਡ ਅਤੇ ਯਾਦਵਿੰਦਰ ਵੀਰ ਮੇਰੀ ਗੱਲ ਸੁਣ ਜੇ ਇਹਦਾ ਤੁਸੀਂ ਰੇਟ ਨਾਲ ਲਾਊਂਗੇ ਕਾਪੀਆਂ ਕਿਤਾਬਾਂ ਜੀਆ ਪੈਨ ਜੋ ਵੀ ਆਪਾਂ ਲੈਣਾ ਜੋ ਹੋਰ ਵੀ ਚੀਜ਼ ਲੈਣੀ ਹੋਈ ਆਪਾਂ ਹੋਰ ਲਵਾਂਗੇ ਤੁਹਾਡੇ ਤੋਂ ਜੋ ਵੀ ਤੁਹਾਡੇ ਕੋਲ ਹੈਗੀ ਆ ਜੇ ਰੇਟ ਨਾਲ ਭਾਅ ਸਿਰ ਲਾਓਂਗੇ ਤੁਸੀਂ ਵੱਧ ਤੋਂ ਵੱਧ ਰਿਹਾਇਤ ਕਰੂਂਗੇ ਸਾਨੂੰ ਚਲੋ ਫਿਰ ਇੱਦਾਂ ਕਰਿਓ ਨਾ ਤੁਸੀਂ ਨਾ ਤੁਸੀਂ ਨਾ ਆਪਣਾ ਜੋ ਰੇਟ ਰੂਟ ਪਾ ਕੇ ਨਾ ਸਾਰਾ ਮੈਨੂੰ ਵਟਸਐਪ 'ਤੇ ਕਾਲ ਕਰਦਿਓ ਜੀ ਵਟਸਐਪ 'ਤੇ ਵਟਸਐਪ 'ਤੇ ਫੋਟੋਆਂ ਪਾ ਦਿਓ ਹਾਂ ਓਕੇ ਵੀਰ ਧੰਨਵਾਦ ਤੇਰਾ ਠੀਕ ਠੀਕ ਥੈਂਕ ਯੂ ਜੀ